ਅਸੀਂ ਆਪਣੇ ਪਿੰਡ ਜਾਂ ਸ਼ਹਿਰ ਨੂੰ ਸਿਹਤ ਸੰਭਾਲ ਆਵਾਜਾਈ ਸਿੱਖਿਆ ਜਾਂ ਹੋਰ ਦ੍ਰਿਸ਼ਟੀਕੋਣਾਂ ਤੋਂ ਬਿਹਤਰ ਬਣਾਉਣ ਲਈ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਕੁਛ ਕੁਛ ਦੂਰੀ 'ਤੇ ਜਿਹੜੇ ਹੈ ਪਿੰਡ ਉਨ੍ਹਾਂ ਦੇ ਵਿੱਚ ਹਸਪਤਾਲਾਂ ਦਾ ਜਿਹੜਾ ਹੈ ਤਾਂ ਕਿ ਬਹੁਤ ਯਾਨੀ ਦੁਰ ਸੜਕ ਦੁਰਘਟਨਾਵਾਂ ਜਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆ ਹੈ ਉਹਨਾਂ ਤੋਂ ਬਚਣ ਦੇ ਲਈ ਸਭ ਤੋਂ ਪਹਿਲਾਂ ਇੱਕ ਹਸਪਤਾਲ ਜਾਂ ਫਿਰ ਕਲੀਨਿਕ ਤਾਂ ਐਟਲੀਸਟ ਹੋਵੇ ਹੀ ਉਸ ਤੋਂ ਇਲਾਵਾ ਆਵਾਜ਼ਾਈ ਨੂੰ ਠੀਕ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਜਿਹੜੀ ਸੜਕਾਂ ਹੈ ਉਹ ਵਧੀਆ ਹੋਣੀ ਚਾਹੀਦੀਆਂ ਹੈ ਪਾਣੀ ਦਾ ਹੈ ਜਿਹੜਾ ਪਰੋਪਰ ਨਿਕਾਸ ਹੋਣਾ ਚਾਹੀਦਾ ਸੜਕਾਂ ਦੇ ਪਾਣੀ ਹੈ ਜਿਹੜਾ ਨਾ ਖੜਿਆ ਹੈ ਸੌ ਦੈਟ ਸੜਕਾਂ ਦੇ ਵਿੱਚ ਖੱਡੇ ਨਾ ਹੋਣ ਅਤੇ ਉਹਨਾਂ ਤੋਂ ਦੁਰਘਟਨਾ ਸੜਕ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾਂ ਸਿੱਖਿਆਂ ਨੂੰ ਬਿਹਤਰ ਬਣਾਉਣ ਦੇ ਲਈ ਹਰ ਪਿੰਡ ਦੇ ਵਿੱਚ ਇੱਕ ਸਕੂਲ ਤਾਂ ਐਟਲੀਸਟ ਹੋਣਾ ਹੀ ਚਾਹੀਦਾ ਹੈ ਸੋ ਦੈਟ ਜਿੱਥੇ ਬੱਚੇ ਹੈ ਜਿਹੜੇ ਉਹ ਗਰੀਬ ਬੱਚੇ ਮੁਫ਼ਤ ਦੀ ਸਿੱਖਿਆ ਹੈ ਜਿਹੜੀ ਉਹ ਪ੍ਰਾਪਤ ਕਰ ਸਕਣ ਸ਼ੌ ਦੇੈਟ ਜਿਹੜੇ ਪਿੰਡ ਹੈ ਜਾਂ ਸ਼ਹਿਰ ਹੈ ਉਨ੍ਹਾਂ ਨੂੰ ਬਿਹਤਰ ਜੋ ਵੀ ਮੇਨ ਲੋੜਾਂ ਹੈ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਬਿਹਤਰ ਬਣਾਇਆ ਜਾ ਸਕੇ